ਹੈਲੋ ਸਤਿ ਸ਼੍ਰੀ ਅਕਾਲ ਅਸੀਂ ਪੰਜਾਬੀ ਸੱਭਿਆਚਾਰਕ ਕਲੱਬ ਵੱਲੋਂ ਬੋਲਦੇ ਪਏ ਹਾਂ ਅੱਛਾ ਸਾਡੇ ਕੋਲ ਨਾ ਪੰਜਾਬੀ ਸੱਭਿਆਚਾਰਕ ਨੂੰ ਵੀ ਜੁੜੇ ਚੀਜ਼ਾਂ ਹੈਗੀਆਂ ਜਿੱਦਾਂ ਕਿ ਭੰਗੜਾ ਤੁਸੀਂ ਤੂੰਬੀ ਵਜਾਉਣਾ ਸਿੱਖ ਸਕਦੇ ਹੋ ਜਾਂ ਗੱਤਕਾ ਖੇਡਣਾ ਸਿਖਵਾ ਸਕਦੇ ਹੋ ਅਤੇ ਜਿਹੜੇ ਮਤਲਬ ਬੱਚੇ ਦਾ ਵਿੱਚ ਇਸ ਕਲੱਬ ਵਿੱਚ ਉਹਨਾਂ ਨੂੰ ਪ੍ਰੋਪਰ ਮਹਿਕਮਾ ਵਿੱਚ ਟਰੇਨਿੰਗ ਦਿੱਤੀ ਜਾਂਦੀ ਹੈ ਅਤੇ ਪ੍ਰੋਪਰ ਉਹਨਾਂ ਨੂੰ ਉਹਦਾ ਕੋਡ ਦੱਸਿਆ ਜਾਂਦਾ ਕਿ ਪੰਜਾਬੀ ਲੋਕ ਸਮੂਹ ਦੁਆਰਾ ਸਿੱਧੀ ਵਿਸ਼ੇਸ਼ ਕੀ ਚੀਜ਼ਾਂ ਸੀ ਤੇ ਤੁਸੀਂ ਦੱਸ ਸਕਦੇ ਹੋ ਤੁਹਾਡੇ ਹਾਂਜੀ ਹਾਂਜੀ ਹਾਂਜੀ ਸਾਡੀ ਸੁਮੇਲ ਹੈਗਾ ਅੱਧੇ ਅੱਗੇ ਅੱਗੇ ਪੰਜਾਬ ਤੋਂ ਅੱਗੇ ਵੀ ਕਈਆਂ ਨਾਲ ਜਿਹਨਾਂ ਦੀਆਂ ਕੰਪਟੀਸ਼ਨ ਕਰਵਾਏ ਜਾਂਦੇ ਹਨ ਅਤੇ ਵਿਭਿੰਨਤਾ ਅਤੇ ਜੀਵਨ ਸੱਭਿਆਚਾਰ ਨਾਲ ਭਰਪੂਰ ਇਹ ਖੇਤਰ ਹੈਗਾ ਅਸੀਂ ਇਹਨਾਂ ਨੂੰ ਪ੍ਰੋਪਰ ਕੱਪੜੇ ਖੇਡਾਂ ਸਭ ਕੁਛ ਬਾਰੇ ਦੱਸਦੇ ਹਨ ਅਤੇ ਭੰਗੜਾ ਵੀ ਸਿੱਖ ਤੁਹਾਡੇ ਬੱਚੇ ਦੀ ਕਿਸ ਚੀਜ਼ ਵਿੱਚ ਰੁਚੀ ਹੈਗੀ ਹੈ ਅੱਛਾ ਅੱਛਾ ਅਤੇ ਭੰਗੜਾ ਉਹਨੂੰ ਆਉਂਦਾ ਹੈ ਪਹਿਲਾਂ ਜਾਂ ਨਹੀਂ ਆਉਂਦਾ ਓਕੇ ਭੰਗੜੇ ਦੀ ਠੀਕ ਹੈ ਭੰਗੜੇ ਦੀ ਵਿਸ਼ੇਸ਼ਤਾ ਜ਼ੋਰਦਾਰ ਹੁੰਦੀ ਹੈ ਅਤੇ ਜ਼ੋਰਦਾਰ ਹਰਕਤਾ ਜਾਵੇ ਛਾਲਾ ਮਾਰ ਮਾਰ ਕੇ ਬੱਚਾ ਕਰਦਾ ਉਹਦੇ ਨਾਲ ਬੱਚੇ ਦੇ ਅੰਦਰੋਂ ਵੀ ਮਨੋਬਲ ਬਣਦਾ ਹੈ ਅਤੇ ਮੈਂ ਤੁਹਾਨੂੰ ਇਹ ਹੀ ਕਹਾਂਗੀ ਕਿ ਤੁਸੀਂ ਆਪਣੇ ਬੱਚੇ ਨੂੰ ਸਾਡੇ ਕੋਲ ਲੈ ਕੇ ਆਇਓ ਅਤੇ ਅਸੀਂ ਉਹਦਾ ਦੇਖਾਂਗੇ ਕਿ ਉਹਨੂੰ ਕਿੰਨਾ ਭੰਗੜਾ ਆਉਂਦਾ ਅਤੇ ਉਹਨੂੰ ਕਿੱਦਾਂ ਭੰਗੜਾ ਅੱਗੇ ਸਿਖਾਇਆ ਜਾ ਸਕਦਾ ਹੈ ਅਤੇ ਹੋਰ ਤੁਸੀਂ ਕੀ ਜਾਣਨਾ ਚਾਹੁੰਦੇ ਹੋ ਹਾਂਜੀ ਸਾਡੀ ਨਾ ਹਿਸਟਰੀ ਅਤੇ ਸਾਡੀ ਇਹ ਡਿਸਟ੍ਰਿਕਟ ਲੈਵਲ 'ਤੇ ਹੁੰਦੀਆਂ ਕਲਾਸਿਸ ਜਿਹਦਾ ਕੁਛ ਯੋਗਦਾਨ ਸਰਕਾਰ ਦੇ ਖਾਤੇ ਵਿੱਚ ਵੀ ਜਾਂਦਾ ਹੈ ਅਤੇ ਕੁਛ ਯੋਗਦਾਨ ਸਾਡੇ ਵਿੱਚ ਆਉਂਦਾ ਅਤੇ ਸਾਡੀ ਜਿਹੜੀ ਫੀਸ ਹੈ ਉਹਦਾ ਵੀਹ ਪ੍ਰਸੈਂਟ ਅਸੀਂ ਸਰਕਾਰ ਨੂੰ ਵੀ ਦਿੰਦੇ ਹਾਂ ਅਤੇ ਇਹਨਾਂ ਦੀ ਕਲਾਸਿਜ ਜਿਹੜੀਆਂ ਹੈਗੀਆਂ ਉਹ ਦੋਨੋਂ ਹੈ ਜੇ ਅਸੀਂ ਐਂਡ ਵੀਕ 'ਤੇ ਵੀ ਸੈਟਰਡੇ ਸੰਡੇ ਵੀ ਲੈਂਦੇ ਹਾਂ ਅਤੇ ਅਸੀਂ ਪਹਿਲਾਂ ਵੀ ਲੈਂਦੇ ਹਾਂ ਅਤੇ ਫਿਰ ਵੀ ਜੇ ਤੁਹਾਡਾ ਬੱਚਾ ਬਹੁਤ ਰੁੱਝਿਆ ਰਿਹਾ ਤਾਂ ਅਸੀਂ ਆਨਲਾਈਨ ਕਲਾਸਾਂ ਵੀ ਦਿੰਦੇ ਹਾਂ ਅਤੇ ਤੁਸੀਂ ਅ ਮਤਲਬ ਬੱਚੇ ਨੂੰ ਪੁੱਛੋ ਅਤੇ ਬੱਚੇ ਨੂੰ ਸਾਡੇ ਇੱਥੇ ਜ਼ਰੂਰ ਲੈ ਕੇ ਆਓ ਤਾਂ ਕਿ ਅਸੀਂ ਜਾਣ ਸਕੀਏ ਤੁਹਾਡੇ ਬੱਚੇ ਦੀ ਕਿਸ ਵਿੱਚ ਰੁਚੀ ਹੈਗੀ ਠੀਕ ਹੈ ਜੀ ਅਸੀਂ ਤੁਹਾਡਾ ਇੰਤਜ਼ਾਰ ਕਰਾਂਗੇ ਅਤੇ ਸਾਨੂੰ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਤੁਸੀਂ ਥਰਮਾ ਲੈ ਕੇ ਜਦੋਂ ਮਰਜ਼ੀ ਸਾਡੇ ਕੋਲ ਆਇਓ ਅਤੇ ਤੁਹਾਡੇ ਬੱਚਿਆਂ ਨੂੰ ਇੱਥੇ ਜਾਮਾ ਦਾਖਲ ਕਰਵਾਓ